ਸਾਡੇ ਖਿਆਲ ਨਾਲ਼ ਸਾਡੇ ਛੋਟੇ ਅਤੇ ਦਰਮਿਆਨੀ ਅਕਾਰ ਦੇ ਫਾਰਮਾਂ ਵਿੱਚ ਅਸੀਂ ਜ਼ਿਆਦਾ ਮਤਲਬ ਕਿ ਫਸਲ ਤਾਂ ਨਹੀਂ ਕਰ ਸਕਦੇ ਪਰ ਅਸੀਂ ਉਹਨਾਂ ਦੇ ਵਿੱਚ ਸਬਜ਼ੀਆਂ ਯਾ ਫਲਾਂ ਦੇ ਲਗਾ ਕੇ ਆਪਣਾ ਫਾਇਦਾ ਲੈ ਸਕਦੇ ਹਨ ਜਿਹਨਾਂ ਦੇ ਨਾਲ਼ ਸਾਡੇ ਪਰਿਵਾਰ ਦੇ ਮੈਂਬਰ ਵੀ ਕੰਮ ਰਲ ਕੇ ਕਰ ਸਕਦੇ ਹਨ ਅਤੇ ਸਾਨੂੰ ਫਾਇਦਾ ਵੀ ਹੋ ਸਕਦਾ ਹੈ